ਜੀਐਸਟੀ ਦਾ ਪੂਰਾ ਨਾਂ ਗੁਡਸ ਐਂਡ ਸਰਵਿਸਸ ਟੈਕਸ ਹੈ ਜੇਕਰ ਕੋਈ ਛੋਟਾ ਕਾਰੋਬਾਰ ਕਰਦੇ ਹਾਂ ਤਾਂ ਉਸਦੇ ਲਈ ਜੀਐਸਟੀ ਦਾ ਰਜਿਸਟਰੇਸ਼ਨ ਕਰਵਾਉਣਾ ਲਾਜ਼ਮੀ ਹੈ ਜੀਐਸਟੀ ਦੇ ਰਜਿਸਟਰੇਸ਼ਨ ਚਾਰ ਤਰ੍ਹਾਂ ਦੇ ਹੁੰਦੇ ਹਨ ਆਈਜੀਐਸਟੀ ਐਸਜੀਐਸਟੀ ਸੀਜੀਐਸਟੀ ਯੂਟੀਜੀਐਸਟੀ ਆਈਜੀਐਸਟੀ ਦਾ ਪੂਰਾ ਨਾਂ ਇੰਟੀਗਰੇਟਡ ਗੁਡ ਐਂਡ ਸਰਵਿਸ ਟੈਕਸ ਹੈ ਐਸਜੀਐਸਟੀ ਦਾ ਪੂਰਾ ਨਾਂ ਸਟੇਟ ਗੁਡਸ ਐਂਡ ਸਰਵਿਸਸ ਟੈਕਸ ਹੈ ਸੀਜੀਐਸਟੀ ਦਾ ਪੂਰਾ ਨਾਂ ਸੈਂਟਰਲ ਗੁਡਸ ਐਂਡ ਸਰਵਿਸਸ ਟੈਕਸ ਹੈ ਯੂਟੀਜੀਐਸਟੀ ਦਾ ਪੂਰਾ ਨਾਂ ਯੂਨੀਅਨ ਟਰਮੇਟਸ ਗੁੱਡਸ ਐਂਡ ਸਰਵਿਸਸ ਟੈਕਸ ਹੈ ਚਾਲ੍ਹੀ ਲੱਖ ਤੋਂ ਘੱਟ ਟਰਨਓਵਰ ਵਾਲੇ ਕਾਰੋਬਾਰ ਨੂੰ ਜੀਐਸਟੀ ਦੀ ਛੂਟ ਕਾਰੋਬਾਰ ਦੇ ਰੂਪ ਵਿੱਚ ਮਾਨਤਾ ਮਿਲਦੀ ਹੈ ਕਰ ਨੂੰ ਅਦਾ ਕਰਨ ਵਾਸਤੇ ਰਜਿਸਟਰੇਸ਼ਨ ਕਰਵਾਉਣਾ ਜ਼ਰੂਰੀ ਹੁੰਦਾ ਹੈ ਜੇਕਰ ਅਸੀਂ ਬਿਨਾਂ ਰਜਿਸਟਰੇਸ਼ਨ ਤੋਂ ਕਾਰੋਬਾਰ ਕਰਦੇ ਹਾਂ ਤਾਂ ਉਹ ਇੱਕ ਅਪਰਾਧ ਹੈ ਜਿਸ ਦਾ ਫੜੇ ਜਾਣ 'ਤੇ ਭਾਰੀ ਜੁਰਮਾਨਾ ਭਰਨਾ ਪੈਂਦਾ ਹੈ